ਜੀ ਹਾਂ ਅਸੀਂ ਪਹਾੜ ਟੁੱਟਣ ਦੀ ਸਥਿਤੀ ਦੇਖੀ ਸੀ ਮੈਂ ਆਪਣੇ ਨਾਨਕੇ ਜੋ ਕਿ ਹਿਮਾਚਲੀ ਖੇਤਰ ਵਿੱਚ ਪੰਜ ਮਤਲਬ ਕਿ ਪਹਾੜੀ ਖੇਤਰ ਵਿੱਚ ਦਰਜ ਹਨ ਉੱਥੇ ਭਾਰੀ ਮੀਂਹ ਪਿਆ ਸੀ ਜਿਸ ਕਰਕੇ ਸਲਾਬਾ ਕਾਰਨ ਪਹਾੜ ਖਿਸਕ ਗਿਆ ਸੀ ਅਤੇ ਅਸੀਂ ਉਸ ਤੋਂ ਸੌ ਜਾਂ ਦੋ ਸੌ ਮੀਟਰ ਦੀ ਦੂਰੀ 'ਤੇ ਮਤਲਬ ਕਿ ਬਾਹਰ ਘੁੰਮਣ ਆਏ ਸੀ ਇੱਕਦਮ ਇਹ ਅਚਾਨਕ ਹਾਦਸਾ ਬੀਤ ਗਿਆ ਤਾਂ ਅਸੀਂ ਸਭ ਤੋਂ ਪਹਿਲਾਂ ਕਿ ਆਪਣਾ ਉੱਥੇ ਅਸੀਂ ਤਾਂ ਬਚ ਗਏ ਸੀ ਨੇੜੇ ਤੇੜੇ ਅਸੀਂ ਹੀ ਸੀ ਉਸ ਤੋਂ ਬਾਕੀ ਸਾਰੇ ਨਾਲੇ ਤਾਂ ਦੂਰ ਸੀ ਅਸੀਂ ਸਾਰਿਆਂ ਨਾਲੋਂ ਪਹਿਲਾਂ ਆਪਣੀ ਸੇਫਟੀ ਦਾ ਧਿਆਨ ਰੱਖਦੇ ਹੋਏ ਉੱਥੇ ਰਸਤਾ ਬੰਦ ਕਰ ਦਿੱਤਾ ਗਿਆ ਕਿ ਜੋ ਵੀ ਸਾਡੇ ਤੋਂ ਬਾਅਦ ਉੱਥੇ ਆਉਣ ਉਹ ਅਗਾਂਹ ਆ ਕੇ ਨਾ ਜਾਣ ਅਤੇ ਅਸੀਂ ਉਹ ਪੁਲਿਸ ਵਾਲਿਆਂ ਨੂੰ ਵੀ ਇਨਫੋਰਮ ਕਰ ਦਿੱਤਾ ਸੀ ਅਤੇ ਆਪਣਾ ਜੋ ਵੀ ਉੱਥੇ ਉਸ ਸੜਕ ਤੋਂ ਜਾ ਰਹੇ ਸੀ ਸਾਰਿਆਂ ਨੂੰ ਮਨਾਹੀ ਕਰ ਦਿੱਤੀ ਸੀ ਕਿ ਅੱਗੇ ਖ਼ਤਰਾ ਹੈ